ਜਾਨਵਰਾਂ ਦੇ ਡੰਗਾਂ ਤੋਂ ਬਚਣ ਦੇ ਲਈ ਜਿਵੇਂ ਕਿ ਕਿਸੇ ਵਿਅਕਤੀ ਨੂੰ ਕਿਸੇ ਜਾਨਵਰ ਜਿਵੇਂ ਸੱਪ ਜਾਂ ਕੀੜੇ ਨੇ ਡੰਗ ਲਿਆ ਹੋਵੇ ਤਾਂ ਉਸਨੂੰ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਹੈ ਜੇਕਰ ਉਸ ਸਮੇਂ ਡਾਕਟਰੀ ਸਹਾਇਤਾ ਉਪਲਬ ਨਾ ਹੋਵੇ ਤਾਂ ਐਂਟੀਬਾਓਟਿਕ ਦੀ ਵਰਤੋਂ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਰੋਗੀ ਨੂੰ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ ਜਿਵੇਂ ਕਿ ਡੰਗੇ ਹੋਏ ਅੰਗ ਨੂੰ ਜੇ ਹੋ ਸਕੇ ਤਾਂ ਉਥੋਂ ਕੱਟ ਦੇਣਾ ਚਾਹੀਦਾ ਹੈ ਨਹੀਂ ਤਾਂ ਜੋਰਦਾਰ ਕੱਪੜਾ ਬੰਨਣਾ ਚਾਹੀਦਾ ਹੈ ਜਿਸ ਨਾਲ ਕਿ ਜ਼ਹਿਰ ਅੱਗੇ ਨਾ ਫੈਲ ਸਕੇ ਅਤੇ ਹੋ ਸਕੇ ਤਾਂ ਜਲਦੀ ਤੋਂ ਜਲਦੀ ਡਾਕਟਰ ਕੋਲ ਲੈ ਜਾਇਆ ਜਾਣਾ ਚਾਹੀਦਾ ਹੈ